ਛੇ ਅਕਤੂਬਰ ਉੱਨੀ ਸੌ ਬਿਆਸੀ ਦਸ ਅਪ੍ਰੈਲ ਦੋ ਹਜ਼ਾਰ ਚਾਰ ਛੇ ਸਤੰਬਰ ਦੋ ਹਜ਼ਾਰ ਸੋਲ੍ਹਾਂ ਦਸੰਬਰ ਉੱਨੀ ਸੌ ਅਠਵੰਜਾ ਵੀਹ ਜਨਵਰੀ ਉੱਨੀ ਸੌ ਸਤਾਸੀ